ਸਾਡੇ ਰਾਜ ਵਿੱਚ ਦਿਵਾਲੀ ਵਿਸਾਖੀ ਗੁਰਪੁਰਬ ਹੋਲੀ ਬੜੇ ਹੀ ਸ਼ਾਨ ਨਾਲ ਮਨਾਇਆ ਜਾਂਦਾ ਹੈ ਬੜਾ ਹੀ ਗੱਜ ਵੱਜ ਕੇ ਮਨਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਅਗਰ ਦਿਵਾਲੀ ਦੀ ਗੱਲ ਕਰੀਏ ਤਾਂ ਦਿਵਾਲੀ ਦੀ ਤਿਆਰੀਆਂ ਦੋ ਮਹੀਨੇ ਤਿੰਨ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ ਦਿਵਾਲੀ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਦਿਵਾਲੀ ਦਾ ਤਿਉਹਾਰ ਮਨਾਉਣ ਲਈ ਅਸੀਂ ਇੰਨੇ ਐਕਸਾਈਟਿਡ ਹੁੰਦੇ ਸੀ ਕਿ ਦਿਵਾਲੀ ਮਨਾਵਾਂਗੇ ਅਤੇ ਦਿਵਾਲੀ 'ਚ ਪਟਾਕੇ ਚਲਾਵਾਂਗੇ ਮਿਠਾਈਆਂ ਖਾਣ ਨੂੰ ਮਿਲਣਗੀਆਂ ਦੀਵਾਲੀ 'ਚ ਘਰ ਸਜਾਵਾਂਗੇ ਦਿਵਾਲੀ ਦੀ ਸਫਾਈਆਂ ਕਰਾਂਗੇ ਤਾਂ ਬੜਾ ਹੀ ਵਧੀਆ ਲੱਗਦਾ ਸੀ ਦਿਵਾਲੀ ਦਾ ਤਿਉਹਾਰ ਅਤੇ ਦਿਵਾਲੀ ਜਦੋਂ ਆਉਂਦੀ ਸੀ ਤਾਂ ਇੰਨੀ ਗੱਜ ਵੱਜ ਕੇ ਮਨਾਈ ਜਾਂਦੀ ਸੀ ਤਾਂ ਅਸੀਂ ਉਸ ਦਿਨ ਸਾਰਾ ਦਿਨ ਮਿਠਾਈ ਖਾਂਦੇ ਸੀ ਪਟਾਕੇ ਚਲਾਉਂਦੇ ਸੀ ਸ਼ਾਮ ਨੂੰ ਉਸ ਦਿਨ ਇਹ ਹੁੰਦਾ ਸੀ ਕਿ ਹਾਂ ਜਾ ਕੇ ਬਾਜ਼ਾਰੋਂ ਪਟਾਕੇ ਲੈ ਕੇ ਆਵਾਂਗੇ ਘਰ ਸਜਾਵਾਂਗੇ ਬੜੀਆਂ ਨਵੀਆਂ ਚੀਜ਼ਾਂ ਖੋਲ੍ਹ ਖੋਲ੍ਹ ਕੇ ਲਾਉਂਦੇ ਸੀ ਅਤੇ ਜੇ ਅਸੀਂ ਈਦ ਦੀ ਕ੍ਰਿਸਮਸ ਦੀ ਵਿਸਾਖੀ ਦੀ ਗੱਲ ਕਰੀਏ ਤਾਂ ਵਿਸਾਖੀ ਵੀ ਬੜੀ ਗੱਜ ਵੱਜ ਕੇ ਮਨਾਈ ਜਾਂਦੀ ਹੈ ਇਸ ਦਿਨ ਮੇਲਾ ਵੀ ਲੱਗਦਾ ਹੈ ਅਤੇ ਬੜਾ ਹੀ ਵਧੀਆ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਲੋਕ ਜਲੇਬੀਆਂ ਖਾਣ ਨੂੰ ਮਿੱਠਾ ਖਾਣ ਨੂੰ ਲਿਆਉਂਦੇ ਹਨ ਅਤੇ ਜੇ ਅਸੀਂ ਈਦ ਦੀ ਗੱਲ ਕਰੀਏ ਤਾਂ ਈਦ ਵੀ ਬੜੇ ਵਧੀਆ ਤਰ੍ਹਾਂ ਮਨਾਇਆ ਜਾਂਦਾ ਹੈ ਗੁਰਪੁਰਬ ਇਸ ਦਿਨ ਜਲਸਾ ਨਿਕਲਦਾ ਹੈ ਅਤੇ ਅਸੀਂ ਇਸ ਦਿਨ ਲੰਗਰ ਖਾਣ ਗੁਰਦੁਆਰਾ ਜਾਂਦੇ ਹਾਂ ਅਤੇ ਪਾਠ ਸੁਣਦੇ ਹਾਂ ਅਤੇ ਬੜਾ ਹੀ ਵਧੀਆ ਗੁਰਪੁਰਬ ਮਨਾਇਆ ਜਾਂਦਾ ਹੈ ਥੈਂਕ ਯੂ